ਜਿਵੇਂ ਕਿ ਆਹਾ ਆਪਾਂ ਨੂੰ ਪਤਾ ਹੀ ਹੈ ਕਿ ਪੁਰਾਣੇ ਸਮੇਂ ਵਿੱਚ ਜਿਵੇਂ ਕਿ ਸਾਡੇ ਮਾਤਾਵਾਂ ਜਾਂ ਮੇਰੀਆਂ ਭੈਣਾਂ ਹੱਥੀ ਜਿਆਦਾ ਕੰਮ ਕਰਦੀਆਂ ਸਨ ਤੇ ਬਿਜਲੀ ਦਾ ਜਾਂ ਹੋਰ ਕਿਸੇ ਕੋਈ ਵੀ ਇਲੈਕਟਰਿਕ ਸਾਧਨ ਇਨਾ ਨਹੀਂ ਉਪਲਬਧ ਸੀ ਸਮੇਂ ਦੀ ਰਫਤਾਰ ਦੇ ਨਾਲ ਨਾਲ ਬਿਜਲੀ ਸਾਧਨਾਂ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਜਿਆਦਾ ਸੁਖਾਲਾ ਕੀਤਾ ਸਾਡੇ ਘਰਾਂ ਵਿੱਚ ਅਸੀਂ ਆਮ ਹੀ ਦੇਖਦੇ ਆ ਕਿ ਇਨ ਇਸ ਬਿਜਲੀ ਉਪਕਰਨਾਂ ਨੇ ਕੰਮਾਂ ਨੂੰ ਇਨਾ ਜਿਆਦਾ ਸੌਖਾ ਕਰ ਦਿੱਤਾ ਕਿ ਟਾਈਮ ਦੀ ਬੱਚਤ ਹੁੰਦੀ ਹੈ ਤੇ ਖਾਣਾ ਵੀ ਬਹੁਤ ਵਧੀਆ ਢੰਗ ਨਾਲ ਬਣਨ ਲੱਗ ਰਿਹਾ ਜਿਵੇਂ ਕਿ ਪਹਿਲਾਂ ਲਾਈਟ ਦੀ ਸਹੂਲਤ ਨਹੀਂ ਸੀ ਲਾਈਟ ਆ ਗਈ ਸਾਰੀ ਬਿਜਲੀ ਮਸ਼ੀਨਾਂ ਹੋ ਗਈਆਂ ਇਲੈਕਟਰਿਕ ਚੁੱਲੇ ਹੋ ਗਏ ਇਹ ਇਸ ਤਰ੍ਹਾਂ ਵੱਖ ਵੱਖ ਪ੍ਰਕਾਰ ਦੇ ਕਈ ਉਪਕਰਨਾਂ ਨੇ ਸਾਡੇ ਜ਼ਿੰਦਗੀ ਨੂੰ ਬਹੁਤ ਸੁਖਾਲਾਂ ਕੀਤਾ ਹੈ ਪੁਰਾਣੇ ਸਮੇਂ ਵਿੱਚ ਮੇਰੇ ਮਾਤਾ ਜੀ ਹੱਥੀ ਦਿਧ ਦੁੱਧ ਰਿੜਕਦੇ ਰਹੇ ਸਨ ਤੇ ਜਿਨਾਂ ਦੀ ਜਗ੍ਹਾ ਹੁਣ ਅੱਜ ਕੱਲ ਮਧਾਣੀ ਨੇ ਲੈ ਲਈ ਐ ਜੋ ਕਿ ਇੱਕ ਬਿਜਲਈ ਉਪਕਰਨ ਹੈ ਇਸੇ ਪ੍ਰਕਾਰ ਹੋਰ ਬਹੁਤ ਸਾਰੀਆਂ ਉਦਾਹਰਨਾਂ ਹਨ ਜਿਨਾਂ ਨੇ ਸਾਡੀ ਬਿਜਲੀ ਉਪਕਰਨਾਂ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਜਿਆਦਾ ਸੁਖਾਲਿਆ ਕੀਤਾ ਹੈ